ਅਸੀਂ ਆਪਣੇ ਘਰ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਸਾਫ ਰੱਖਣ ਲਈ ਬਹੁਤ ਤਰ੍ਹਾਂ ਦੇ ਉਪਾਏ ਦਿਨੋਂ ਦਿਨ ਪ੍ਰਤੀ ਦਿਨ ਕਰਦੇ ਰਹਿੰਦੇ ਹਾਂ ਜਿਸ ਵਿੱਚ ਅਸੀਂ ਸਭ ਤੋਂ ਪਹਿਲੇ ਜਾ ਕੇ ਸਾਰੇ ਇਲਾਕਿਆਂ ਦੇ ਜਿਹੜੇ ਵੀ ਇਲਾਕੇ ਦੇ ਬੰਦੇ ਹੈਗੇ ਹੈ ਉਹਨਾਂ 'ਚ ਇੱਕ ਬੜੀ ਚੰਗੀ ਤਰ੍ਹਾਂ ਮੁਹਿੰਮ ਚਲਾਉਂਦੇ ਹਾਂ ਜਿਸ ਵਿੱਚ ਸਫਾਈ ਦੇ ਰੱਖਣ ਦੇ ਅਲੱਗ ਤਰ੍ਹਾਂ ਦੇ ਉਪਾਏ ਸਾਰੇ ਦੱਸਦੇ ਰਹਿੰਦੇ ਆ ਇਲਾਕੇ ਵਾਸੀਆਂ ਨੂੰ ਅਸੀਂ ਉੱਥੇ ਅਲੱਗ ਅਲੱਗ ਮੈਂਬਰਾਂ ਦੀ ਕਮੇਟੀ ਬਣਾਉਂਦੇ ਹਾਂ ਜੋ ਕਿ ਪੂਰੇ ਇਲਾਕੇ ਦੀ ਸੜਕਾਂ ਅਤੇ ਜਿੰਨੇ ਵੀ ਨਾਲੇ ਜਿੰਨੇ ਵੀ ਧਾਰਮਿਕ ਸਥਲ ਹੈ ਜਿੰਨੇ ਵੀ ਪਾਰਕ ਹੈ ਜਿੰਨੇ ਵੀ ਸਭ ਕੁਛ ਹੈ ਉੱਥੇ ਜਿੱਥੇ ਜਿੱਥੇ ਡਸਟਬਿਨ ਰਖਾਏ ਜਾਂਦੇ ਹਨ ਅਤੇ ਲੋਕਾਂ ਨੂੰ ਆਹੀ ਕਿਹਾ ਜਾਂਦਾ ਹੈ ਕਿ ਆਪਣਾ ਸ਼ ਆਪਣਾ ਇਲਾਕਾ ਸਾਫ ਸੁਥਰਾ ਰੱਖਣਾ ਹੈ ਅਸੀਂ ਬਾਰਿਸ਼ ਤੋਂ ਪਹਿਲੇ ਹਰ ਤਿੰਨ ਮਹੀਨੇ ਜਾਂ ਜੋ ਵੀ ਟਾਈਮ ਸਾਨੂੰ ਵਧੀਆ ਲੱਗਦਾ ਹੈ ਉਸ ਤੋਂ ਪਹਿਲੇ ਅਸੀਂ ਸਾਰੇ ਨਾਲਿਆਂ ਦੀ ਕਾਰਪੋਰੇਸ਼ਨ ਦੇ ਦੀ ਮਦਦ ਦੇ ਨਾਲ ਅਤੇ ਇਲਾਕਾ ਵਾਸੀਆਂ ਦੀ ਮਦਦ ਦੇ ਨਾਲ ਉਹ ਸਾਰੇ ਦੇ ਸਾਰੇ ਜੋ ਨਾਲੇ ਹੈ ਉਹ ਸਾਰੀ ਸਫਾਈ ਕਰਵਾਉਂਦੇ ਹਾਂ ਜਿਸ ਕਰਕੇ ਜਦੋਂ ਬਾਰਿਸ਼ ਆਏ ਅਤੇ ਅਸੀਂ ਉਸ ਚੀਜ਼ ਦਾ ਸਾਨੂੰ ਕੋਈ ਵੀ ਨੁਕਸਾਨ ਨਾ ਆਏ ਨਾ ਹੀ ਸਾਡੇ ਘਰਾਂ ਵਿੱਚ ਪਾਣੀ ਆਏ ਆਹ ਉਪਾਏ ਸਾਰੇ ਇਲਾਕਿਆਂ ਦੀ ਮਦਦ ਨਾਲ ਹੀ ਸਾਰੇ ਕੰਮ ਸੰਪੂਰਨ ਹੋ ਸਕਦੇ ਹਨ